ਹਾਂਜੀ ਭਾਅ ਜੀ ਤੁਹਾਡਾ ਧੰਨਵਾਦ ਤੁਸੀਂ ਪਟਿਆਲਾ ਸਾਨੂੰ ਕੱਲ੍ਹ ਲੈ ਕੇ ਵੀ ਗਏ ਤੇ ਅੱਜ ਛੱਡਣ ਵੀ ਆਏ ਸੁਰੱਖਿਅਤ ਛੱਡ ਗਏ ਗਿਆਰਾਂ ਵਜੇ ਗਿਆਰਾਂ ਵੱਜ ਗਏ ਰਾਤ ਰਾਤ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਗੇ ਨੂੰ ਵੀ ਲੋੜ ਪਈ ਤੁਹਾਨੂੰ ਏ ਕਰਨ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਜੀ ਆ ਜਾਉ ਤੁਸੀਂ ਰੋਟੀ ਪਾਣੀ ਖਾ ਕੇ ਚੱਲ ਜਾਇਉ ਭਾਅ ਜੀ ਧੰਨਵਾਦ ਜੀ ਤੁਹਾਡਾ